ਸਤਿ ਸ਼੍ਰੀ ਅਕਾਲ ਜੀ ਮੈਂ ਮੈਂ ਫੂਡ ਬਲੋ ਬਲੋਗਰ ਹਾਂ ਜੀ ਹਾਂਜੀ ਮੈਂ ਇਹ ਪੁੱਛਣਾ ਚਾਹੁੰਦਾ ਜੀ ਪੁੱਛਣਾ ਸੀ ਮੈਂ ਠੀਕ ਹੈ ਜੀ ਅੱਛਾ ਠੀਕ ਹੈ ਜੀ ਹਾਂਜੀ ਅੱਛਾ ਅੱਛਾ ਅੱਛਾ ਅੱਛਾ ਜੀ ਠੀਕ ਹੈ ਅਤੇ ਮਤਲਬ ਹੋਰ ਸਮੋਸੇ ਵਗੈਰਾ ਅੱਛਾ ਠੀਕ ਹੈ ਜੀ ਅੱਛਾ ਅੱਛਾ ਅਤੇ ਬਰਗਰ ਮਤਲਬ ਵਧੀਆ ਬਰਗਰ ਵੀ ਮਿਲ ਜਾਣਗੇ ਇੱਥੋਂ ਹੀ ਠੀਕ ਹੈ ਠੀਕ ਹੈ ਜੀ ਅੱਛਾ ਅੱਛਾ ਅੱਛਾ ਜੀ

ਅਤੇ ਠੀਕ ਆ ਮਤਲਬ ਬਈ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਅਤੇ

ਠੀਕ ਹੈ ਜੀ ਅਤੇ ਮਤਲਬ ਦੁਕਾਨ ਦਾ ਨਾਮ ਮਤਲਬ ਜੀ ਅੱਛਾ ਜੀ ਠੀਕ ਹੈ ਜੀ

ਅੱਛਾ ਅੱਛਾ ਅਤੇ ਮਤਲਬ ਹਾਂਜੀ ਹਾਂਜੀ ਬਰਗਰ ਵੀ ਮਿਲ ਜਾਣਗੇ ਜੀ

ਅੱਛਾ ਅੱਛਾ ਜੀ ਹੋਰ ਮਤਲਬ ਕੁਲਵੰਤ ਕੌਰ ਜੀ ਹਾਂਜੀ ਹਾਂਜੀ ਧੰਨਵਾਦ ਜੀ ਠੀਕ ਹੈ ਜੀ

ਜੀ ਚੰਡੀਗੜੋਂ ਜੀ ਹਾਂਜੀ ਹਾਂਜੀ ਇਹਨਾਂ 'ਤੇ ਪਾਈਆਂ ਹੋਈਆਂ ਜੀ ਜਲੰਧਰ ਗਈ ਸੀ ਮੈਂ ਪਿੱਛੇ ਜਿਹੇ ਹਾਂਜੀ ਇਹ ਚੀਜ਼ ਵਧੀਆ ਹੈ ਜੀ ਵਧੀਆ ਜੀ ਹਾਂਜੀ ਠੀਕ ਹੈ ਜੀ ਮੈਂ ਖਾ ਕੇ ਦੇਖਾਂਗੀ ਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਤੁਸੀਂ ਤੁਸੀਂ ਆਪਦਾ ਨੰਬਰ ਦੇ ਦਿਓ ਜੀ ਠੀਕ ਹੈ ਜੀ ਬਾਕੀ ਠੀਕ ਧੰਨਵਾਦ ਜੀ